ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਮ ਹਮ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਸਰ ਮੈਂ ਹੈਲਪ ਕਰਾਂਗਾ ਤੁਹਾਡੀ ਅਤੇ ਸਰ ਪਟਿਆਲਾ ਦੇ ਵਿੱਚ ਬਹੁਤ ਸਾਰੀਆਂ ਖਾਣ ਪੀਣ ਦੀਆਂ ਬੇਕਰੀ ਦੀਆਂ ਸ਼ੋਪਸ ਹੈ ਅਤੇ ਬਟ ਜੇ ਮੈਂ ਫੇਮਸ ਬੇਕਰੀਜ ਦੀ ਗੱਲ ਕਰਾਂ ਤਾਂ ਤਿੰਨ ਚਾਰ ਮੈਂ ਤੁਹਾਨੂੰ ਦੱਸ ਦਿੰਦਾ ਉੱਥੇ ਤੁਸੀਂ ਜ਼ਰੂਰ ਜਾ ਕੇ ਆਪਣਾ ਜੋ ਵੀ ਸ਼ੂਟ ਕਰਨਾ ਬਲੋਗ ਕਰਨਾ ਕਰ ਸਕਦੇ ਹੋ ਅਤੇ ਫਿਰ ਸਭ ਤੋਂ ਪਹਿਲਾਂ ਕੁਆਲਿਟੀ ਬੇਕਰੀ ਆ ਬਹੁਤ ਪੁਰਾਣੀ ਬੇਕਰੀ ਏ ਪਟਿਆਲੇ ਦੀ ਇੱਕ ਤਾਂ ਇਹ ਆਪਣਾ ਬਿਲਕੁਲ ਬਿਲਕੁਲ ਸਰ ਸ਼ਹਿਰ ਦੇ ਵਿੱਚ ਅਨਾਰਦਾਨਾ ਚੌਂਕ ਦੇ ਵਿੱਚ ਹੈ ਇਹ ਅਤੇ ਇੱਕ ਤਾਂ ਇਕਨੋਮਿਕਲ ਬਹੁਤ ਹੈ ਪ੍ਰਾਈਸਸ ਇਹਨਾਂ ਦੇ ਬਹੁਤ ਜੈਨੂਇਨ ਹੈ ਅਤੇ ਦੂਜਾ ਸਰ ਇਹ ਬਹੁਤ ਹਾਈਜੀਨਕ ਹੈ ਇੱਥੇ ਹਾਈਜੀਨ ਬੜਾ ਧਿਆਨ ਰੱਖਦੇ ਆ ਮੈਂ ਵੀ ਮਤਲਬ ਇਹਨਾਂ ਤੋਂ ਹੀ ਲੈ ਕੇ ਆਉਂਦਾ ਸਮਾਨ ਪੈਟੀ ਵਗੈਰਾ ਰਸਾਂ ਵਗੈਰਾ ਬਿਸਕੁਟ ਬਹੁਤ ਇਹਨਾਂ ਦੇ ਬਾਹਰ ਤੱਕ ਜਾਂਦੇ ਆ ਦੂਰ ਤੱਕ ਅਤੇ ਉਸ ਤੋਂ ਬਾਅਦ ਫਿਰ ਇੱਕ ਪੁਰਾਣੀ ਬੇਕਰੀ ਹੋਰ ਹੈ ਸਾਨੀ ਬੇਕਰੀ ਅਤੇ ਇਹ ਵੀ ਹਾਂਜੀ ਪਹਿਲਾਂ ਤਾਂ ਬਾਈ ਨੰਬਰ ਫਾਟਕ ਕੋਲ ਸੀ ਮੇਨ ਉਸ ਤੋਂ ਬਾਅਦ ਹੁਣ ਇਹਨਾਂ ਨੇ ਆਪਣੀਆਂ ਤਿੰਨ ਚਾਰ ਬਰਾਂਚਿਸ ਇਹਨਾਂ ਨੇ ਖੋਲੀਆਂ ਵਾਈ ਪੀ ਐਸ ਸਕੂਲ ਕੋਲੇ ਇੱਕ ਇਹਨਾਂ ਦੀ ਬਰਾਂਚ ਅਤੇ ਇੱਕ ਇਹਨਾਂ ਦੀ ਤ੍ਰਿਪੜੀ ਸਾਈਡ ਦੇ ਵਿੱਚ ਬਰਾਂਚ ਹੈਗੀ ਹੈ ਸਰ ਅਤੇ ਇਹਨਾਂ ਦੀ ਵੀ ਮਤਲਬ ਬਹੁਤ ਵਧੀਆ ਕੁਆਲਿਟੀ ਹੈ ਸਭ ਕੁਝ ਵਧੀਆ ਇਹਨਾਂ ਦਾ ਵੀ ਵਰਾਇਟੀ ਮੈਕਸੀਮਮ ਵਰਾਇਟੀ ਬੇਕਰੀ ਪ੍ਰੋਡਕਟਸ ਦੀ ਇਹਨਾਂ ਕੋਲ ਹੈ ਪਟਿਆਲੇ ਦੇ ਵਿੱਚ ਅਤੇ ਉਸ ਤੋਂ ਬਾਅਦ ਫਿਰ ਇੱਕ ਵਰਮਾ ਬੇਕਰੀ ਤੁਸੀਂ ਜ਼ਰੂਰ ਜਾ ਸਕਦੇ ਹੋ ਬਾਈ ਨੰਬਰ ਫਾਟਕ ਕੋਲ ਹੀ ਏ ਅਤੇ ਹੈ ਤਾਂ ਮਤਲਬ ਇਹ ਠੀਕ ਠਾਕ ਮਤਲਬ ਛੋਟੀ ਜਿਹੀ ਬੇਕਰੀ ਆ ਕੋਈ ਬਹੁਤ ਵੱਡੀ ਨਹੀਂ ਏ ਬਟ ਇਹਨਾਂ ਦੀ ਕੁਆਲਿਟੀ ਬਹੁਤ ਅੱਛੀ ਹੈ ਅਤੇ ਪੁਰਾਣੀ ਬੇਕਰੀ ਏ ਬਹੁਤ ਫਰੈਸ਼ ਔਰ ਟੇਸਟੀ ਇਹਨਾਂ ਦਾ ਸਮਾਨ ਹੁੰਦਾ ਅਤੇ ਇੱਕ ਸਰ ਬੇਕਰੀ ਜੀਤ ਬੇਕਰੀ ਏ ਪਟਿਆਲਾ ਦੇ ਵਿੱਚ ਅਤੇ ਇਸ ਬੇਕਰੀ ਦੀ ਖਾਸ ਗੱਲ ਇਹ ਸੀਗੀ ਕਿ ਸਭ ਤੋਂ ਪਹਿਲਾਂ ਜੋ ਐਗਲੈਸ ਚੀਜ਼ਾਂ ਸੀਗੀਆਂ ਉਹ ਇਹਨਾਂ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਐਗਲੈਸ ਕੇਕ ਅਤੇ ਹੋਰ ਵੀ ਮਤਲਬ ਜਿੰਨੀਆਂ ਵੀ ਬੇਕਰੀ ਆਈਟਮਸ ਹੈ ਐਗਲੈਸ ਅਤੇ ਇਸ ਟਾਈਮ ਇਹਨਾਂ ਨੇ ਵੀ ਐਕਸਪੈਂਡ ਕਰ ਲਿਆ ਬਹੁਤ ਅੱਛੀ ਬੇਕਰੀ ਹੈ ਤ੍ਰਿਪੜੀ ਦੇ ਵਿੱਚ ਹੈ ਇਹਨਾਂ ਦੀ ਜਿਹੜੀ ਸ਼ੋਪ ਹੈ ਅਤੇ ਉਹ ਵੀ ਤੁਸੀਂ ਕਰ ਸਕਦੇ ਹੋ ਅਤੇ ਇਹ ਚਾਰ ਬੇਕਰੀਜ਼ ਹੈ ਇਸ ਤੋਂ ਇਲਾਵਾ ਹੈ ਤਾਂ ਬਹੁਤ ਹੈ ਬਟ ਤੁਸੀਂ ਟਾਈਮ ਜਿੰਨਾ ਤੁਹਾਡੇ ਕੋਲ ਹੋਏਗਾ ਅਤੇ ਇਹ ਚਾਰ ਚਾਰ ਬੇਕਰੀਜ਼ ਦੇ ਵਿੱਚ ਤੁਸੀਂ ਜ਼ਰੂਰ ਜਾ ਕੇ ਮਤਲਬ ਕਰ ਸਕਦੇ ਹੋ ਬਲੋਗ ਕਵਰ ਹਾਂਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਹਾਂਜੀ ਹਾਂਜੀ ਥੈਂਕ ਯੂ ਜੀ ਓਕੇ